ਅਸੀਂ ਆਪਣੀਆਂ ਛੋਟੀਆਂ ਕਲਾਸਾਂ ਤੋਂ ਹੀ ਇਹ ਯੋਗੇ ਬਾਰੇ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ ਜਿਸ ਦਿਨ ਵਿੱਚ ਸਾਨੂੰ ਯੋਗਾ ਦੇ ਵੱਖ ਵੱਖ ਤਰ੍ਹਾਂ ਦੇ ਨਿਯਮ ਵੀ ਸਮਝਾਏ ਜਾਂਦੇ ਹਨ ਅਤੇ ਇਸ ਦੇ ਨਾਲ ਹੋਣ ਵਾਲੇ ਫ਼ਾਇਦੇ ਵੀ ਸਾਨੂੰ ਦੱਸੇ ਗਏ ਹਨ ਜਿਸ ਕਰਕੇ ਅਸੀਂ ਆਪਣੇ ਜੀਵਨ ਦੇ ਵਿੱਚ ਹੁਣ ਤੱਕ ਯੋਗਾ ਨੂੰ ਸ਼ਾਮਿਲ ਕੀਤਾ ਹੋਇਆ ਹੈ ਇਸ ਦੇ ਨਾਲ ਹੀ ਸਾਨੂੰ ਪਤਾ ਹੈ ਕਿ ਯੋਗਾ ਅਤੇ ਯੋਗਾ ਕਰਨ ਦੇ ਨਾਲ ਮਨੁੱਖ ਦਾ ਸਰੀਰ ਸਰੀਰ ਅਤੇ ਮਾਨਸਿਕ ਵਿਕਾਸ ਹੁੰਦਾ ਹੈ ਇਸ ਦੇ ਨਾਲ ਹੀ ਮਨੁੱਖ ਜੋ ਕਿ ਆਲਸੀ ਹੁੰਦੇ ਹਨ ਯੋਗਾ ਕਰਨ ਦੇ ਨਾਲ ਆਲਸੀ ਮਨੁੱਖ ਵੀ ਆਲਸੀ ਮਨੁੱਖ ਵੀ ਵਧੀਆ ਚੰਗੇ ਅਤੇ ਤੇਜ਼ ਬਣ ਜਾਂਦੇ ਹਨ ਇਸ ਦੇ ਨਾਲ ਯੋਗਾ ਕਰਨ ਵਾਲੇ ਯੋਗਾ ਕਰਨ ਵਾਲੇ ਆਪਣੀ ਸਪੈਸੀਫਿਕ ਗੋਲਸ ਦੇ ਉੱਤੇ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਹਨ ਉਹਨਾਂ ਦਾ ਲਾਈਫ ਸਟਾਈਲ ਜਿਊਣ ਦਾ ਲਾਈਫ ਸਟਾਈਲ ਵਧੀਆ ਹੋ ਜਾਂਦਾ ਹੈ ਜਿਸ ਦੇ ਨਾਲ ਉਹਨਾਂ ਦਾ ਮਾਨਸਿਕ ਵਿਕਾਸ ਅਤੇ ਸਰੀਰਿਕ ਵਿਕਾਸ ਵੀ ਹੁੰਦਾ ਹੈ ਉਹਨਾਂ ਦੇ ਮਨ ਦੇ ਵਿੱਚ ਵੱਖ ਵੱਖ ਤਰ੍ਹਾਂ ਦੀ ਵਧੀਆ ਤੋਂ ਵਧੀਆ ਵਿਚਾਰ ਆਉਂਦੇ ਹਨ ਉਹਨਾਂ ਦੇ ਵਿੱਚ ਜੋ ਵੀ ਗਲਤ ਭਾਵਨਾਵਾਂ ਹੁੰਦੀਆਂ ਹਨ ਉਹ ਘੱਟ ਹੋ ਜਾਂਦੀਆਂ ਹਨ ਜਾਂ ਦੂਰ ਹੋ ਜਾਂਦੀਆਂ ਹਨ